ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦੇ ਮਹੱਤਵ ਅਤੇ ਮੌਕੇ ਨਹੀਂ ਦਿੱਤੇ ਜਾਂਦੇ ਹਨ ਕਿਉਂਕਿ ਅੱਜ ਕੱਲ੍ਹ ਦੇ ਮਸ਼ੀਨੀ ਯੁੱਗ ਹੈ ਹਰ ਕੰਮ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਹੈ ਇਸ ਲਈ ਕਲਾਕਾਰਾਂ ਦੀ ਕੀਮਤ ਨਹੀਂ ਰਹਿ ਗਈ ਅੱਜ ਕੱਲ੍ਹ ਵੈਸੇ ਪੈਸੇ ਨਾਲ ਸਾਰੇ ਕੰਮ ਹੁੰਦੇ ਹਨ ਜੇਕਰ ਤੁਸੀਂ ਤੁਸੀਂ ਕੋਈ ਕਲਾਕਾਰੀ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਹੋਰਾਂ ਨੂੰ ਮੌਕੇ ਦਿੱਤੇ ਜਾਂਦੇ ਹਨ ਕਲਾਕਾਰਾਂ ਨੂੰ ਅਸੀਂ ਬੇਰੁਜ਼ਗਾਰੀ ਵਿੱਚ ਦੇਖਦੇ ਹਾਂ ਕਿਉਂਕਿ ਉਹਨਾਂ ਕੋਲ ਤਾਂ ਕੋਈ ਕੰਮ ਨਹੀਂ ਹੈ ਜਿਹਨਾਂ ਕੋਲ ਪੈਸੇ ਹਨ ਉਹ ਰਿਸ਼ ਰਿਸ਼ਵਤ ਦੇ ਕੇ ਨੌਕਰੀ ਲੈ ਲੈਂਦੇ ਹਨ ਅਤੇ ਜਿਹਨਾਂ ਕੋਲ ਕੋਈ ਕਲਾ ਹੁੰਦੀ ਹੈ ਤਾਂ ਉਹ ਹੋਰ ਕੋਈ ਕਾਰੋਬਾਰ ਕਰ ਰਹੇ ਹਨ ਇਸ ਲਈ ਸਰਕਾਰ ਨੂੰ ਲੋੜੀਂਦਾ ਮੌਕੇ ਦਿੱਤੇ ਜਾਂਦੇ ਹਨ